ਅਸੀਂ ਜ ਸ਼ਹਿਰ ਵਿੱਚ ਰਹਿੰਦੇ ਹਾਂ ਜਲੰਧਰ ਸ਼ਹਿਰ ਵਿੱਚ ਅਤੇ ਸਾਨੂੰ ਫਿਲਟਰ ਪਾਣੀ ਪੀਣ ਦੀ ਆਦਤ ਪਈ ਹੋਈ ਹੈ ਪਰ ਜਦੋਂ ਵੀ ਅਸੀਂ ਆਪਣੇ ਨਾਨਕੇ ਪਿੰਡ ਵਿੱਚ ਜਾਂਦੇ ਹਾਂ ਕੁਛ ਦਿਨਾਂ ਦੇ ਲਈ ਰਹਿਣ ਲਈ ਉੱਥੇ ਉਹਨਾਂ ਨੂੰ ਪਾਣੀ ਸਪਲਾਈ ਟੂਟੀ ਵਾਲਾ ਮਿਲਦਾ ਹੈ ਜੋ ਕਿ ਬਹੁਤ ਗੰਦਾ ਵੀ ਹੁੰਦਾ ਹੈ ਪਰ ਉਹਨਾਂ ਨੂੰ ਆਪਣੀ ਪਿਆਸ ਮਿਟਾਉਣ ਲਈ ਉਹ ਪੀਣਾ ਪੈਂਦਾ ਹੈ ਅਤੇ ਉਸ ਕਰਕੇ ਉਹਨਾਂ ਨੂੰ ਤਾਂ ਆਦਤ ਹੈ ਹੀ ਪੀਣ ਦੀ ਗੰਦਾ ਪਾਣੀ ਪਰ ਜਦੋਂ ਅਸੀਂ ਉੱਥੇ ਜਾ ਕੇ ਪੀਂਦੇ ਹਾਂ ਤਾਂ ਸਾਡੇ ਪੇਟ ਵਿੱਚ ਬਹੁਤ ਦਰਦ ਉੱਠਦੀ ਹੈ ਜਿਹਦੇ ਕਰਕੇ ਸਾਨੂੰ ਤਕਲੀਫ ਬਹੁਤ ਜ਼ਿਆਦਾ ਝੇਲਣੀ ਪੈਂਦੀ ਹੈ ਅਤੇ ਸਾਨੂੰ ਚਾਹੀ ਤਾਂ ਸਾਨੂੰ ਚਾਹੀਦਾ ਹੈ ਕਿ ਸਾਨੂੰ ਇਸ ਦੀ ਸ਼ਿਕਾਇਤ ਕਰਨ ਵੇਲੇ ਕੋਈ ਵੀ ਦ ਡਰ ਨਹੀਂ ਰੱਖਣਾ ਚਾਹੀਦਾ ਕਿ ਸਾਨੂੰ ਪਾਣੀ ਦੀ ਸਪਲਾਈ ਸਹੀ ਤਰੀਕੇ ਦੇ ਨਾਲ ਨਹੀਂ ਮਿਲ ਰਹੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੱਦਾਂ ਜਿੱਦਾਂ ਹੋ ਸਕੇ ਜਿੰਨਾ ਜਲਦੀ ਹੋ ਸਕੇ ਸਾਨੂੰ ਪਾਣੀ ਦੀ ਸਪਲਾਈ ਸਹੀ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਕਿ ਉਹਨਾਂ ਬੱਚਿਆਂ ਨੂੰ ਵੀ ਕੋਈ ਵੀ ਦੁੱਖ ਤਕਲੀਫ ਨਾ ਝੇਲਣਾ ਪਵੇ ਅਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਣ ਅਤੇ ਇੱਦਾਂ ਸਾਨੂੰ ਬਹੁਤ ਬਿਮਾਰੀਆਂ ਦਾ ਵੀ ਭਾ ਝੇਲਣਾ ਪੈਣਾ ਜਿੱਦਾਂ ਕਿ ਬਿਮਾਰੀਆਂ ਦੇ ਕਾਰਨ ਕੋਈ ਬੱਚਾ ਪੜ੍ਹ ਲਿਖ ਵੀ ਨਹੀਂ ਸਕਦਾ ਜੇ ਕੋਈ ਬੱਚਾ ਪੜ੍ਹ ਲਿਖ ਹੀ ਨਹੀਂ ਸਕੇਗਾ ਤਾਂ ਉਹ ਅੱਗੇ ਦੇਸ਼ ਨੂੰ ਕਿੱਦਾਂ ਪਰਿਵਰਤਨ ਕਰੇਗਾ ਇਸ ਲਈ ਮੈਂ ਚਾਹਨਾ ਹਾਂ ਮੈਂ ਚਾਹੁੰਦੀ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਪਾਣੀ ਵੱਲ ਆਪਣਾ ਹੱਥ ਵਧਾਉਣਾ ਚਾਹੀਦਾ ਹੈ ਤਾਂ ਕਿ ਉਹ ਟੂਟੀ ਵਾਲਾ ਪਾਣੀ ਵੀ ਬਿਲਕੁਲ ਸਾਫ਼ ਹੋਵੇ